ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਅੱਛਾ ਪਟਿਆਲੇ ਤੋਂ ਪਟਿਆਲੇ ਤੋਂ ਅੱਛਾ ਅੱਛਾ ਅੱਛਾ ਅੱਛਾ ਜੀ ਨਵਾਂ ਕੰਮ ਆ ਅੱਛਾ ਅੱਛਾ ਹਾਂਜੀ ਹਾਂਜੀ ਅੱਛਾ ਜੀ ਤੇ ਤੁਸੀਂ ਇਹ ਜਿਹੜੀਆਂ ਪਾਈਪਾਂ ਪਾਉਣੀਆਂ ਉਹ ਪਲਾਸਟਿਕ ਵਾਲੀਆਂ ਪਾਉਣੀਆਂ ਕਿ ਲੋਹੇ ਵਾਲੀਆਂ ਅੱਛਾ ਹਾਂਜੀ ਹਾਂਜੀ ਅਤੇ ਤੁਸੀਂ ਠੇਕਾ ਹੀ ਕਰੋਗੇ ਕਿ ਦੂਸਰਾ ਕਰਨਾ ਵਾ ਸਕੇਅਰ ਫੁੱਟ ਨਾਲ ਇਹਦਾ ਵੈਸੇ ਤਾਂ ਰੇਟ ਅਸੀਂ ਲੈਂਦੇ ਵੀ ਤੇਰਾਂ ਚੌਦਾਂ ਰੁਪਏ ਹੁੰਦਾ ਸਕੇਅਰ ਫੁੱਟ ਦਾ ਅਤੇ ਬਾਕੀ ਤੁਹਾਡਾ ਪਹਿਲਾਂ ਆ ਕੇ ਸਾਰਾ ਏਰੀਆ ਮਾਪਣਾ ਪਏਗਾ ਕਿੰਨੀਆਂ ਪਾਈਪਾਂ ਪੈਣਗੀਆਂ ਸਾਰਾ ਵਗੈਰਾ ਛੱਤ ਕਿੰਨੀ ਆ ਅਤੇ ਕੰਧਾਂ ਵਗੈਰਾ 'ਚ ਕਿੰਨੀਆਂ ਕਿੰਨੀਆਂ ਕਿੱਥੇ ਕਿੱਥੇ ਪੈਣੀਆਂ ਪਾਈਪਾਂ ਅਤੇ ਬਾਕੀ ਸਰ ਆ ਕੇ ਪਤਾ ਲੱਗੇਗਾ ਅਤੇ ਵੈਸੇ ਅਪਰੋਕਸੀਮੇਟ ਹੁੰਦਾ ਸਾਡਾ ਵੀ ਚੌਦਾਂ ਕ ਰੁਪਏ ਸਕੇਅਰ ਫੁੱਟ ਦੇ ਹਿਸਾਬ ਨਾਲ ਅਸੀਂ ਕਰਦੇ ਹਾਂ ਕੰਮ ਸਾਰਾ ਹਮ ਹਮ ਸ਼ਨੀ ਐਤਵਾਰ ਹਾਂਜੀ ਐਤਵਾਰ ਨੂੰ ਐਤਵਾਰ ਨੂੰ ਮਿਲ ਪੈਂਦੇ ਦੁਪਹਿਰੇ ਜੀ ਠੀਕ ਹੈ ਠੀਕ ਹੈ ਵੀਰੇ ਮੈਂ ਇਸੇ ਨੰਬਰ 'ਤੇ ਤੁਹਾਨੂੰ ਕੰਟੈਕਟ ਕਰ ਲੂੰਗਾ ਐਤਵਾਰ ਨੂੰ ਠੀਕ ਠੀਕ ਹੈ ਠੀਕ ਹੈ ਉਹ ਬਸ ਆ ਕੇ ਸਾਰਾ ਪਤਾ ਕਰਕੇ ਤੁਹਾਨੂੰ ਦੱਸ ਦੂੰਗਾ ਵੀ ਕਿਹੜਾ ਕਿਹੜਾ ਕਿੰਨਾ ਲੱਗਦਾ ਹੈ ਓਕੇ ਓਕੇ ਓਕੇ ਵੀਰ